ਭੰਗੜੇ ਦੇ ਪ੍ਰਦਰਸ਼ਨ ਲਈ ਆਮ ਤੌਰ 'ਤੇ ਮੁੰਡੇ ਧੋਤੀ ਕੁੜਤਾ ਅਤੇ ਪੱਗੜੀ ਪਾਉਂਦੇ ਹਨ ਅਤੇ ਕੁੜੀਆਂ ਪੰਜਾਬੀ ਸਲਵਾਰ ਸੂਟ ਅਤੇ ਘੱਗਰਾ ਚੋਲੀ ਅਤੇ ਦੁਪੱਟਾ ਪਾਉਂਦੀਆਂ ਹਨ ਇਹ ਪੁਸ਼ਾਕਾਂ ਭੰਗੜਾ ਪਾਉਣ ਵਾਲਿਆਂ ਨੂੰ ਆਕਰਸ਼ਕ ਇਸ ਕਰਕੇ ਬਣਾਉਂਦੀਆਂ ਹਨ ਕਿਉਂਕਿ ਕੱਪੜੇ ਦੇ ਗੂੜੇ ਅਤੇ ਚਮਕੀਲੇ ਰੰਗ ਅੱਖਾਂ ਨੂੰ ਭਾਉਂਦੇ ਹਨ ਅਤੇ ਭੰਗੜਾ ਪਾਉਣ ਵਿੱਚ ਜੋਸ਼ ਪੈਦਾ ਕਰਦੇ ਹਨ ਇਸ ਕੱਪੜੇ 'ਤੇ ਹੱਥਾਂ ਨਾਲ ਕੀਤੀ ਕਢਾਈ ਕੱਪੜਿਆਂ ਨੂੰ ਹੋਰ ਆਕਰਸ਼ਕ ਬਣਾਉਂਦੀ ਹੈ ਇਹ ਪੋਸ਼ਾਕਾਂ ਭੰਗੜੇ ਵਿੱਚ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਹਨ ਧੰਨਵਾਦ